ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਕੀ ਤੁਸੀਂ ਬਰਨਾਲਾ ਸਿਵਲ ਹਸਪਤਾਲ 'ਚ ਬੋਲ ਰਹੇ ਹੋ ਮੈਂ ਕੋਵਿਡ ਨਾਈਨਟੀਨ ਦੇ ਟੀਕਾਕਰਨ ਬਾਰੇ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਹਾਂ ਤਾਂ ਜੋ ਮੈਨੂੰ ਕੋਵਿਡ ਨਾਈਨਟੀਨ ਦਾ ਟੀਕਾ ਕਰਵਾਉਣ ਵਿੱਚ ਮੋਟੀਵੇਸ਼ਨ ਮਿਲੇ ਤਾਂ ਜੋ ਮੈਂ ਇਟ ਕੋਵਿਡ ਨਾਈਨਟੀਨ ਦਾ ਟੀਕਾ ਲਗਵਾ ਸਕਾਂ ਟੀਕਾਕਰਨ ਕਰਵਾ ਸਕਾਂ ਮੇਰੇ ਪਰਿਵਾਰ ਵਿੱਚ ਕੋਵਿਡ ਨਾਈਨਟੀਨ ਦਾ ਟੀਕਾ ਹਰ ਇੱਕ ਨੇ ਲਗਾ ਲਿਆ ਹੈ ਵਿਜ਼ ਕੋਵਿਡ ਨਾਈਨਟੀਨ ਦਾ ਟੀਕਾ ਲਵਾਉਣ ਵਾਲੀ ਸਿਰਫ ਔਰ ਸਿਰਫ ਮੇਰੇ ਘਰ 'ਚ ਮੈਂ ਹਾਂ ਕੋਵਿਡ ਨਾਈਨਟੀਨ ਦੇ ਟੀਕੇ ਬਾਰੇ ਮੈਂ ਇਹ ਸਲਾਹ ਲੈਣਾ ਚਾਹੂੰਗੀ ਕਿ ਕੋਵਿਡ ਨਾਈਨਟੀਨ ਦੇ ਟੀਕਾਕਰਨ ਨਾਲ ਕੋਈ ਵੀ ਇਨਫੈਕਸ਼ਨ ਨਹੀਂ ਹੁੰਦੀ ਜੇ ਕੋਈ ਇਨਫੈਕਸ਼ਨ ਜਾਂ ਬਿਮਾਰੀ ਹੁੰਦੀ ਹੈ ਤਾਂ ਇਸ ਟੀਕੇ ਦੀ ਕੋਈ ਵੀ ਦਵਾ ਹੁੰਦੀ ਹੈ ਤੁਸੀਂ ਇਸ ਦੀ ਮੈਨੂੰ ਡੇਟ ਦੱਸ ਦਿਉ ਵੀ ਕਿਸ ਡੇਟ 'ਤੇ ਤੁਸੀਂ ਇਹ ਟੀਕਾਕਰਨ ਕਰ ਸਕਦੇ ਹੋ ਇਹ ਟੀਕਾ ਕ ਕੋਵਿਡ ਨਾਈਨਟੀਨ ਦਾ ਟੀਕਾਕਰਨ ਕਰਵਾਉਣ ਲਈ ਮੈਨੂੰ ਕਿਸ ਸਥਾਨ ਕਿਸ ਦਿਨ ਅਤੇ ਕਿਸ ਡੇਟ ਨੂੰ ਆਉਣਾ ਪਵੇਗਾ ਤੁਸੀਂ ਮੈਨੂੰ ਇਹ ਸਭ ਦੱਸੋਗੇ ਕੋਵਿਡ ਨਾਈਨਟੀਨ ਦੇ ਕਿਰਪਾ ਕਰਕੇ ਤੁਹਾਨੂੰ ਇਹ ਬੇਨਤੀ ਹੈ ਕਿ ਕੋਵਿਡ ਨਾਈਨਟੀਨ ਦੇ ਸਾਈਡ ਇਫੈਕਸ ਜਾਂ ਕੋਵਿਡ ਨਾਈਨਟੀਨ ਦੇ ਟੀ ਟੀਕਾਕਰਨ ਨਾਲ ਕੋਈ ਵੀ ਇਨਫੈਕਸ਼ਨ ਬਿਮਾਰੀਆਂ ਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਬਾਰੇ ਮੈਨੂੰ ਪਹਿਲਾਂ ਦੱਸ ਦੱਸ ਦਿਉ